ਇਕ ਖੂਹ ਤੋਂ ਪਾਣੀ ਜਿਹੜਾ ਸੀਗਾ ਲੋਕ ਪਹਿਲੇ ਜਮਾਨੇ ਵਿੱਚ ਬੈਲ ਦੁਆਰਾ ਅਤੇ ਜਾਂ ਇੱਕ ਮਸ਼ੀਨ ਹੁੰਦੀ ਸੀ ਜਿਹਨੂੰ ਘੁੰਮਾ ਕੇ ਉਹ ਪਾਣੀ ਨੂੰ ਕੱਢਦੇ ਸਨ ਅਤੇ ਖੇਤਾਂ ਦੀ ਸਿੰਚਾਈ ਕਰਦੇ ਸਨ ਉਹਤੇ ਹੁਣ ਜੋ ਹੈ ਉਹ ਮੋਟਰ ਮੱਛੀਆਂ ਸਬਮਰਸੀਬਲ ਜਾਂ ਮੋਟਰਾਂ ਜਿਨ੍ਹਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਨ੍ਹਾਂ ਦੁਆਰਾ ਖੂਹ ਚੋਂ ਹੈ ਜੋ ਪਾਣੀ ਕੱਢਿਆ ਜਾਂਦਾ ਹੈ ਉਹ ਕੀ ਕਰਦੇ ਹਨ ਕਿ ਉਹ ਪਾਈਪਾਂ ਪਾ ਕੇ ਖੂਹ ਵਿੱਚ ਮਸ਼ੀਨ ਚਲਾ ਦਿੰਦੇ ਹਨ ਜਿਸ ਨਾਲ ਪਾਣੀ ਜੋ ਹੈ ਉਹ ਉੱਪਰ ਤੱਕ ਆ ਜਾਂਦਾ ਹੈ ਅਤੇ ਲੋਕ ਉਸਦਾ ਪ੍ਰਯੋਗ ਕਰਦੇ ਹਨ ਇਸ ਤਰ੍ਹਾਂ ਬਹੁਤ ਹੀ ਇਲੈਕਟ੍ਰੋਨਿਕ ਮੈ ਮੋਟਰਾਂ ਜੋ ਹੈ ਉਹ ਆ ਚੁੱਕੀਆਂ ਹਨ ਜਿਸ ਨਾਲ ਜੋ ਖੂਹ ਵਿੱਚੋਂ ਪਾਣੀ ਕੱਢਣਾ ਹੈ ਉਹ ਬਹੁਤ ਹੀ ਜ਼ਿਆਦਾ ਆਸਾਨ ਹੋ ਗਿਆ ਕਿਉਂਕਿ ਸਾਇੰਟਿਸਟ ਨੇ ਇਸ ਦੇ ਲਈ ਖੂਹ ਚੋਂ ਪਾਣੀ ਕੱਢਣ ਲਈ ਜਾਂ ਜਮੀਨ ਤੋਂ ਪਾਣੀ ਕੱਢਣ ਲਈ ਬਹੁਤ ਹੀ ਜ਼ਿਆਦਾ ਇਲੈਕਟ੍ਰੋਨਿਕ ਚੀਜ਼ਾਂ ਬਣਾ ਦਿੱਤੀਆਂ ਗਈਆਂ ਹਨ ਜੋ ਕਿ ਲੋਕ ਹੁਣ ਪੁਰਾਣੀਆਂ ਚੀਜ਼ਾਂ ਨੂੰ ਯੂਜ ਨਾ ਕਰਕੇ ਹੁਣ ਨਵੀਆਂ ਮੋਟਰਾਂ ਇਲੈਕਟ੍ਰੋਨਿਕ ਚੀਜ਼ਾਂ ਦੀ ਵਰਤੋਂ ਕਰਕੇ ਪਾਣੀ ਜੋ ਹੈ ਖੂਹ ਦੇ ਵਿੱਚੋਂ ਬਾਹਰ ਕੱਢਦੇ ਹਨ ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਆ ਵੀ ਇਲੈਕਟ੍ਰੋਨਿਕ ਚੀਜ਼ਾਂ ਦੇ ਵਿੱਚ ਮੋਟਰਸ ਸਮਰਸੀਬਲ ਮੱਛੀ ਮੋਟਰ ਹੋਰ ਬਹੁਤ ਚੀਜ਼ਾਂ ਆ ਗਈਆਂ ਹਨ